ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਮੈਂ ਨਾ ਰਾਜੀਵ ਸੁਖੀਜਾ ਬੋਲ ਰਿਹਾ ਯੂਟਿਊਬਰ ਬਲੋਗਰ ਹਾਂਜੀ ਤੁਸੀਂ ਨਾਮ ਸੁਣਿਆ ਹੋਣਾ ਚੈਨਲ ਦਾ ਰਾਜੀਵ ਸੁਖੀਜਾ ਅਤੇ ਮੈਂ ਐਕਚੁਲੀ ਨਾ ਯੂਟਿਊਬ 'ਤੇ ਵੀਡੀਓਜ ਬਣਾਈ ਹੋਈ ਆ ਜਿਹੜੀ ਬੇਕਰੀਜ ਜਾਂ ਖਾਣ ਪੀਣ ਦੀ ਜਿਹੜੀਆਂ ਆਈਟਮ ਹੁੰਦੀਆਂ ਉਹਦੇ ਰਿਗਾਰਡਿੰਗ ਅਤੇ ਇਸ ਵਾਰ ਫਿਰ ਧਿਆਨ ਬਣਿਆ ਸੀ ਸਾਡੀ ਟੀਮ ਦਾ ਵੀ ਅਸੀਂ ਪਟਿਆਲਾ ਵਿਜਿਟ ਕਰੀਏ ਅਤੇ ਉੱਥੇ ਦੀ ਜਿਹੜੀ ਬੇਕਰੀ ਸ਼ੋਪ ਹੈ ਉਹਨੂੰ ਕਵਰ ਕਰੀਏ ਅਤੇ ਹਾਂ ਉਹਦੇ ਰਿਗਾਰਡਿੰਗ ਨਾ ਤੁਹਾਡਾ ਮੈਨੂੰ ਪਤਾ ਲੱਗਿਆ ਸੀ ਤੁਹਾਡਾ ਟੇਸਟ ਬੜਾ ਅੱਛਾ ਹੈਗਾ ਅਤੇ ਤੁਸੀਂ ਅਲੱਗ ਅਲੱਗ ਵਿਜਿਟ ਕਰਦੇ ਰਹਿੰਦੇ ਹੋ ਅਤੇ ਤੁਹਾਡਾ ਮੈਂ ਬਲੋਗ ਪੜ੍ਹਿਆ ਸੀਗਾ ਅਤੇ ਉਸ ਸਮੇਂ ਮੈਂ ਰੈਫਰੈਂਸ ਲਿਆ ਵੀ ਮੈਂ ਤੁਹਾਡੇ ਨਾਲ ਕੰਸਲਟ ਕਰਾਂ ਵੀ ਮੈਨੂੰ ਪਟਿਆਲਾ ਦੇ ਵਿੱਚ ਕਿਹੜੀ ਕਿਹੜੀ ਬੇਕਰੀਜ਼ ਵਿਜਿਟ ਕਰਨੀਆਂ ਚਾਹੀਦੀਆਂ ਹਾਂ ਹਾਂਜੀ ਹਾਂਜੀ ਹਾਂ ਹਾਂ ਜ਼ਰੂਰ ਜੀ ਜ਼ਰੂਰ ਹਾਂ ਇਹ ਆਈ ਥਿੰਕ ਸ਼ਾਇਦ ਅਨਾਰਦਾਨਾ ਚੌਂਕ ਹੈ ਨਾ ਹਾਂ ਠੀਕ ਠੀਕ ਹੈ ਠੀਕ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਸਰ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਠੀਕ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਓਕੇ ਜੀ ਠੀਕ ਹੈ ਜੀ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਠੀਕ ਆ ਜ਼ਰੂਰ ਜੀ ਸਰ ਥੈਂਕ ਯੂ ਸਰ ਥੈਂਕ ਯੂ ਸੋ ਨਾਈਸ ਆਫ ਯੂ ਸਰ ਬਹੁਤ ਅੱਛਾ ਲੱਗਿਆ ਜੀ ਹਾਂ ਠੀਕ ਹੈ ਸਰ ਠੀਕ ਹੈ ਜੀ ਓਕੇ ਸਰ ਓਕੇ ਜੀ